ਪੰਜਾਬ ਵਿੱਚ ਜੀਵਨ ਦੇ ਢੰਗ ਨੂੰ ਆਕਾਰ ਦੇਣ ਵਾਲੇ ਪ੍ਰਮੁੱਖ ਸੱਭਿਆਚਾਰਕ ਪ੍ਰਭਾਵਤਾ ਸੰਕੇਤ ਹਨ ਜਿੱਦਾਂ ਧਰਮ ਧਰਮ ਤੋਂ ਬਿਨਾਂ ਇਨਸਾਨ ਕੁਛ ਨਹੀਂ ਹੈ ਕੁਛ ਲੋਕਾਂ ਨੇ ਇਹ ਸੋਚ ਲਿਆ ਹੈ ਕਿ ਧਰਮ ਹੈ ਤਾਂ ਅਸੀਂ ਹੈ ਜੇ ਸਿੱਖ ਧਰਮ ਹਿੰਦੂ ਧਰਮ ਕ੍ਰਿਸ਼ਚਨ ਬੋਧੀ ਇਸਾਈ ਇਹਨਾਂ ਦੇ ਵਿਚਲਾ ਪਹਿਰਾਵਾ ਹੀ ਇਹਨਾਂ ਦਾ ਜਿਹੜਾ ਹੈ ਉਹ ਧਰਮ ਦਾ ਹੀ ਨਿਸ਼ਾਨੀ ਹੈ ਤੁਸੀਂ ਵੈਸੇ ਭਾਸ਼ਾ ਜਿਹੜੀ ਆ ਸਾਡੇ ਭਾਸ਼ਾ ਜਿਹੜੀ ਕਬੀਲਿਆਂ 'ਚ ਹੋਰ ਹੈ ਘਰਾਂ 'ਚ ਪੜ੍ਹਿਆਂ ਲਿਖਿਆਂ ਦੀ ਹੋਰ ਹੈ ਅਤੇ ਜਿਹੜੀ ਜ਼ਿਆਦਾ ਪੜ੍ਹ ਜਾਂਦੇ ਉਹਨਾਂ ਦੀ ਖਿਚੜੀ ਹੈ ਜਿੱਦਾਂ ਹਿੰਦੀ ਵਿੱਚ ਮਿਕਸ ਕਰਕੇ ਬੋਲਦੇ ਹਨ ਅਤੇ ਦੂਜਾ ਜਿਹੜਾ ਸਾਡਾ ਇਤਿਹਾਸ ਜਿਹੜਾ ਹੈ ਸਾਡੇ ਜਿਲ੍ਹੇ ਦਾ ਇਤਿਹਾਸ ਸਾਡੇ ਜੀਵਨ ਨੂੰ ਮਜ਼ਬੂਤ ਕਰਦਾ ਸਾਨੂੰ ਆਪਣੇ ਜਿਹੜਾ ਆ ਟੀਚੇ 'ਤੇ ਲੈ ਕੇ ਜਾਂਦਾ ਆ ਵਿਆਹ ਸ਼ਾਦੀਆਂ ਵੀ ਜਿਹੜਾ ਇਤਿਹਾਸ ਹੀ ਹੈ ਜਿਹੜਾ ਸਾਡੇ ਚੱਲੇ ਆ ਰਿਹਾ ਆ ਸ਼ਗਨ ਦਾ ਕੰਗਣਾ ਦਾ ਸਿਹਰੇ ਬੰਦੀ ਦਾ ਅਲੱਗ ਅਲੱਗ ਰਿਵਾਜ਼ ਮਰਨ 'ਤੇ ਭੋਗ 'ਤੇ ਸਾਰਾ ਅਲੱਗ ਅਲੱਗ ਜਿਹੜੇ ਇਤਿਹਾਸ ਹੀ ਹੈ ਜਿਹੜਾ ਸਾਡਾ ਦੁਹਰਾਉਂਦਾ ਹੈ ਸਾਨੂੰ ਮੂਹਰੇ ਲੈ ਕੇ ਆਉਂਦਾ ਦੂਜੇ ਪਾਸੇ ਭੂਗੋਲਿਕ ਸਥਿਤੀ ਦੇ ਵਿੱਚ ਹੈ ਜਿੱਥੇ ਲੋਕ ਜ਼ਿਆਦਾ ਹੋਣਗੇ ਉੱਥੇ ਪ੍ਰਦੂਸ਼ਨ ਜਾਂ ਤੁਹਾਡੀ ਭਾਸ਼ਾ ਜਿਹੜੀ ਇੱਕੋ ਜਿਹੀ ਹੋ ਜਾਂਦੀ ਹੈ ਦੂਸਰੇ ਪਾਸੇ ਤੁਸੀਂ ਇਕੱਲੇ ਰਹਿੰਦੇ ਹੋ ਹਿੱਲ ਸਟੇਸ਼ਨ ਜੇ ਇਕੱਲੇ ਨਾ ਤੁਹਾਡੀ ਭਾਸ਼ਾ ਜਿਹੜੀ ਅਲੱਗ ਹੋ ਗਈ ਫਰਕ ਆਊਗਾ ਤੁਹਾਡੀ ਭਾਸ਼ਾ ਨੂੰ ਜੇ ਸਾਡੇ ਜਿਹੜੇ ਸੱਭਿਆਚਾਰ ਨੂੰ ਪ੍ਰਭਾਵਿਤ ਜਿਹੜਾ ਹੈ ਧਰਮ ਨੇ ਭਾਸ਼ਾ ਨੇ ਇਤਿਹਾਸ ਨੇ ਭੂਗੋਲ ਨੇ ਕੀਤਾ ਹੈ ਅਤੇ ਭੂਗੋਲ ਨੇ ਤੁਸੀਂ ਤੁਸੀਂ ਸਾਡੇ ਘਰ 'ਚ ਰਹਿੰਦੇ ਹੋ ਤੁਹਾਡੀ ਭਾ ਤੁਹਾਡੀ ਜਿਹੜੀ ਪਹਿਰਾਵਾ ਹੋਰ ਹੈ ਬਾਹਰ ਜਾਣਾ ਪਹਿਰਾਵਾ ਹੋਰ ਹੈ ਇਹ ਸਾਡੇ ਜਿਹੜੇ ਪਹਿਰਾਵਾ ਸੱਭਿਆਚਾਰ ਸਾਨੂੰ ਸਾਨੂੰ ਜਿਹੜਾ ਪ੍ਰੇਰਿਤ ਕਰਦਾ ਸਾਡੇ ਜਿਹੜੇ ਧਰਮ ਆ ਸਾਨੂੰ ਇਹ ਜ਼ਿਆਦਾ ਕਰਦਾ ਜਿੱਥੇ ਧਰਮ ਹੈ ਉੱਥੇ ਇਨਸਾਨ ਜਿਹੜਾ ਆ ਸੋਚਣ ਨੂੰ ਮਜਬੂਰ ਹੋ ਜਾਂਦਾ ਕਿ ਮੈਂ ਇੱਥੇ ਆ ਕੇ ਜਿਹੜੀ ਆ ਕੁਛ ਵੀ ਇੱਦਾਂ ਦੀ ਡਰੈਸ ਨਾ ਪਾਵਾਂ ਅਤੇ ਦੂਸਰਾ ਜਿਹੜੀ ਭਾਸ਼ਾ ਹੈ ਸਾਡੀ ਉਹ ਜਦੋਂ ਕਿਸੇ ਨਾਲ ਗੱਲ ਕਰਦੇ ਵੀ ਸਾਡੀ ਭਾਸ਼ਾ ਇੰਨੀ ਅਭੱਦਰ ਨਾ ਲੱਗੇ ਕਿ ਮੈਂ ਅਗਲੇ ਮੂਹਰੇ ਨੀਵਾਂ ਹੋ ਜਾਵਾਂ ਜਾਂ ਮੇਰੇ ਪਰਿਵਾਰ ਨੂੰ ਜਾਂ ਕਿਸੇ ਹੋਰ ਨੂੰ ਨੀਵਾਂ ਹੋਣਾ ਪਵੇ ਵੀ ਸਾਡਾ ਜਿਹੜਾ ਇਤਿਹਾਸ ਆ ਉਹ ਸਾਡਾ ਜਿਹੜਾ ਅਸੀਂ ਚੱਲੇ ਆ ਰਹੇ ਸੀ ਉਸੇ ਹਿਸਾਬ ਨਾਲ ਚੱਲਦੇ ਹਾਂ ਪੰਜਾਬੀ ਨੇ ਇਤਿਹਾਸ ਨੂੰ ਬਦਲਿਆ ਨਹੀਂ ਸਿਰਫ਼ ਇਤਿਹਾਸ ਬਦਲਿਆ ਹੈ